ਉੱਦਾਂ ਨਹੀਂ ਮੈਂ ਕਦੀ ਆਪਣੇ ਗੇਮ ਬਾਕਸ 'ਤੇ ਕੋਈ ਵਰਚੁਅਲ ਵਰਾਈਟੀ ਗੇਮ ਨਹੀਂ ਖੇਡੀ ਪਰ ਮੈਂ ਲੋਕਾਂ ਨੂੰ ਵੇਖਿਆ ਹੈ ਗੇਮ ਖੇਡਦੇ ਕਿਸੇ ਮੌਲਾਂ ਵਗੈਰਾ ਵਿੱਚ ਕਿ ਜਿਵੇਂ ਲੋਕ ਵੀ ਆਰ ਗਲਾਸਿਸ ਪਾ ਕੇ ਆਰ ਪੀ ਜੀ ਗੇਮ ਖੇਡਦੇ ਹਨ ਅਤੇ ਲੋਕਾਂ ਨੂੰ ਕਈ ਵਾਰ ਵੇਖਿਆ ਵੀ ਦੀਵਾਰਾਂ ਵਿੱਚ ਵੱਜਦੇ ਹੋਏ ਮੈਂ ਜਿੱਦਾਂ ਉਹਨਾਂ ਨੂੰ ਲੱਗਦਾ ਕਿ ਸੱਚੀ ਵਿੱਚ ਭੱਜਣਾ ਹੋਣਾ ਪਰ ਭੱਜਦੇ ਨਹੀਂ ਉਹਦੇ ਵਿੱਚ ਭੱਜਦੇ ਨਹੀਂ ਉਹਦੇ ਵਿੱਚ ਬੱਸ ਹੱਥਾਂ ਦੀ ਹੱਥਾਂ ਨੂੰ ਹਿਲਾ ਹਿਲਾ ਕੇ ਇੱਧਰ ਉੱਧਰ ਚੱਲਣਾ ਹੁੰਦਾ ਅਤੇ ਮੈਂ ਵੇਖਿਆ ਵਾ ਇੰਨਜੁਏ ਵਲ ਬੜੀ ਮਜ਼ੇਦਾਰ ਦੀ ਚੀਜ਼ ਹੈਗੀ ਪਰ ਕਦੇ ਕੀਤੀ ਨਹੀਂ ਮੈਂ ਹਾਲੇ